ਹਾਂਜੀ ਪਰਮਿੰਦਰ ਸਿੰਘ ਬੋਲ ਰਿਹਾ ਜੀ ਸਰ ਜੀ ਜੀ ਹਾਂਜੀ ਦੱਸੋ ਜੀ ਠੀਕ ਹੈ ਜੀ ਜ਼ਰੂਰ ਜੀ ਜੀ ਬਿਲਕੁਲ ਜ਼ਰੂਰ ਦੱਸੋ ਜੀ ਮੇਰਾ ਮੁੱਖ ਕ ਮੁੱਖ ਕਾਰੋਬਾਰ ਮੈਂ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਾਉਂਦਾ ਜੀ ਨਾਲ ਸਾਡਾ ਖੇਤੀ ਦਾ ਕੰਮ ਹੈ ਜੀ ਸਰ ਦੇਖੋ ਖੇਤੀ ਦਾ ਕੋਈ ਬਹੁਤਾ ਲਾਹੇਵੰਦ ਸੌਦਾ ਰਿਹਾ ਨਹੀਂ ਹੁਣ ਪਰਿਵਾਰ ਦੇ ਸਾਰੇ ਮੈਂਬਰ ਉੱਥੇ ਹੀ ਲੱਗੇ ਹੋਏ ਆ ਉਸ ਤੋਂ ਬਿਨਾ ਮੈਂ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਾਉਂਦਾ ਉੱਥੇ ਮੈਨੂੰ ਗੁਜ਼ਾਰੇ ਜੋਗੇ ਪੈਸੇ ਆ ਜਿਹੜੇ ਤਿੰਨ ਹਜ਼ਾਰ ਪੈਂਤੀ ਸੌ ਰੁਪਇਆ ਪ੍ਰਾਪਤ ਹੁੰਦਾ

ਸਹਾਇਕ ਧੰਦੇ ਦੇ ਤੌਰ 'ਤੇ ਦੋ ਮੱਝਾਂ ਰੱਖੀਆਂ ਨੇ ਜੀ ਉਹਨਾਂ ਦਾ ਦੁੱਧ ਆ ਘਰ ਵਰਤਦੇ ਹਾਂ ਅਤੇ ਜਿੰਨਾ ਕੁ ਬਾਕੀ ਬਚਦਾ ਉਹ ਡੈਅਰੀ ਦੇ ਵਿਚ ਪਾ ਦਿੰਦੇ ਹਾਂਜੀ ਇੰਨੀ ਸੱਤਰ ਪੰਝੱਤਰ ਹੋ ਜਾਂਦੀ ਆ ਅੱਸੀ ਹੋ ਜਾਂਦੀ ਆ ਇੰਨੀ ਕੁ ਆਮਦਨ ਸਾਨੂੰ ਹੋ ਜਾਂਦੀ ਆ ਜੀ ਪਰਿਵਾਰ 'ਚ ਅਸੀਂ ਨੌ ਮੈਂਬਰ ਹਾਂ ਜੀ ਹਾਂਜੀ ਸਾਧਨ ਹ ਹੈ ਜੀ ਇੱਕ ਇਲੈਕਟਰਿਕ ਸਕੂਟਰੀ ਹੈ ਜੀ ਦੋ ਸਾਈਕਲ ਨੇ ਜੀ ਏ ਸੀ ਏ ਸੀ ਤਾਂ ਨਹੀਂ ਹੈ ਜੀ ਫਰਿਜ ਹੈਗਾ ਕੂਲਰ ਹੈਗਾ ਪੱਖੇ ਹੈਗੇ ਆ ਜੀ ਲੋੜੀਂਦੀਆਂ ਚੀਜ਼ਾਂ ਹੈਗੀਆਂ ਜੀ ਹਾਂਜੀ ਬੈਡ ਹੈਗੇ ਆ ਜੀ ਸੋਫੇ ਹੈਗੇ ਆ ਕੁਰਸੀਆਂ ਮੰਜੇ ਪਲਾਸਟਿਕ ਸਾਰਾ ਕੁਝ ਹੈਗਾ ਜੀ ਘਰ ਸਾਡਾ ਆਪਣਾ ਜੀ ਉਹ ਜੱਦੀ ਪੁਸ਼ਤੀ ਹੈ ਜੀ ਸਾਡੇ ਪੁਰਖਿਆਂ ਦਾ ਲਿਆ ਹੋਇਆ ਉਹਦੇ 'ਚ ਵਧੀਆ ਗੁਜ਼ਾਰਾ ਹੋ ਰਿਹਾ ਸਰ ਇਹ ਹੋਊਗਾ ਸਾਡਾ ਮੈਨੂੰ ਲ ਡੇਢ ਸੌ ਗਜ਼ ਦੇ ਕਰੀਬ ਹੋਊਗਾ

ਧੰਨਵਾਦ ਜੀ ਓਕੇ ਓਕੇ ਸਰ